ਮੈਨੂੰ ਕੋਲਜ ਦੇ ਫੰਕਸ਼ਨਾਂ ਦੇ ਵਿੱਚ ਜਾਣਾ ਬੜਾ ਪਸੰਦ ਲੱਗਦਾ ਹੈ ਇੱਕ ਵਾਰ ਮੈਂ ਕੋਲਜ ਦੇ ਫੰਕਸਨ ਵਿੱਚ ਗਿਆ ਤਾਂ ਮੈਨੂੰ ਮੇਰੇ ਦੋਸਤਾਂ ਨੇ ਕੁਝ ਮੈਨੂੰ ਲਿਖਣ ਜਾਂ ਗ ਲਿਖਣ ਲਈ ਕਿਹਾ ਤਾਂ ਮੈਂ ਕੁੜੀ ਦੇ ਸਬੰਧ ਵਿੱਚ ਲਿਖਿਆ ਅਨੁਪਾਤ ਵਿੱਚ ਸਬੰਧ ਵਿੱਚ ਲਿਖਿਆ ਉਹਦੇ ਵਿੱਚ ਲਿਖਿਆ ਗਿਆ ਕਿ ਕੁੜੀਆਂ ਦੇ ਅਨੁਪਾਤ ਵਿੱਚ ਕਿਉਂ ਫਰਕ ਪਾਇਆ ਗਿਆ ਤਾਂ ਮੈਂ ਉਹਨੂੰ ਚੰਗੀ ਤਰ੍ਹਾਂ ਲਿਖਿਆ ਤਾਂ ਇਹ ਇਸ ਲਈ ਇਹ ਕੁੜੀਆਂ ਮਾਂ ਪਿਓ ਦੇ ਸਿਰ ਦਾ ਬੋਝ ਹਨ ਜਾਂ ਫੇਰ ਉਹ ਦਾਜ ਕਰਕੇ ਹੀ ਲਿ ਘੱਟ ਅਨੁਪਾਤ ਕੀਤਾ ਗਿਆ ਤਾਂ ਉਸ ਨੂੰ ਗੋਦ ਵਿੱਚ ਹੀ ਮਾਰਿਆ ਜਾਂਦਾ ਪਰ ਹੁਣ ਦੇ ਜ਼ਮਾਨੇ ਵਿੱਚ ਕੁੜੀਆਂ ਮੁੰਡਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਕੁੜੀ ਨੂੰ ਵੀ ਬਰਾਬਰ ਦਾ ਹੱਕ ਮਿਲ ਗਿਆ ਹੈ ਇਸ ਲਈ ਹੁਣ ਇਹ ਕਵਿਤਾ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਪਸੰਦ ਆਈ ਬਹੁਤ